ਹਾਂਜੀ ਅਸੀਂ ਸਪੋਟੀਫਾਈ ਜਾਂ ਐਪਲ ਮਿਊਜਿਕ ਵਰਗੀ ਸੰਗੀਤ ਸਟੀਮਿੰਗ ਦੀ ਵਰਤੋਂ ਕਰਦੇ ਹਾਂ ਕਿਉਂਕਿ ਐਪਲ ਸਟੀ ਐਪਲ ਮਿਊਜਿਕ 'ਚ ਸਾਊਂਡ ਕੁਆਲਿਟੀ ਕਾਫ਼ੀ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਇਸ ਵਿੱਚ ਸਾਨੂੰ ਮਿਊਜ਼ਿਕ ਵੀਡੀਓਜ ਪੋਡਕਾਸਟ ਰੇਡੀਓ ਐਂਡ ਸ਼ੋਜ ਦੀ ਸੁਵਿਧਾ ਉਪਲੱਬਧ ਹੈ ਸਪੋਟੀਫਾਈ ਦੀ ਮਦਦ ਨਾਲ ਸਾਨੂੰ ਕਾਫ਼ੀ ਤਰ੍ਹਾਂ ਦੇ ਸੰਗੀਤ ਔਡੀਓ ਬੁੱਕਸ ਪੋਡਕਾਸਟ ਦੀ ਸੁਵਿਧਾ ਮਿਲਦੀ ਹੈ ਜਿਸ ਦੇ ਨਾਲ ਨਾਲ ਸਾਨੂੰ ਫਰੀ ਸਟਰੀਮਿੰਗ ਦੀ ਸੁਵਿਧਾ ਵੀ ਮਿਲਦੀ ਹੈ ਜਿਹਦੇ ਨਾਲ ਅਸੀਂ ਔਨਲਾਈਨ ਘਰ ਬੈਠੇ ਹਰ ਤਰ੍ਹਾਂ ਦੇ ਕੋਈ ਪਲੈਨਸ ਲਗ ਲੈਣੇ ਹੋਣ ਜਾਂ ਕੋਈ ਔਨਲਾਈਨ ਕੰਮ ਕਰਨਾ ਹੋਏ ਸੋਸ਼ਲ ਮੀਡੀਆ 'ਤੇ ਵੀ ਕੰਮ ਇਸ ਦੌਰਾਨ ਅਸੀਂ ਘਰ ਬੈਠੇ ਕਰ ਸਕਦੇ ਹਾਂ ਜਿਸ ਦੀ ਮਦਦ ਦੇ ਨਾਲ ਸਾਊਂਡ ਕੁਆਲਿਟੀ ਦੇ ਨਾਲ ਨਾਲ ਸਾਨੂੰ ਵੀਡੀਓਜ਼ ਮੂਵੀਜ ਸ਼ੋਜ ਐਕਸੈਕਟ੍ਰਾ ਕਾਫ਼ੀ ਰੇਡੀਓਗ੍ਰਾਫੀ ਦਾ ਵੀ ਕੰਮ ਅਸੀਂ ਘਰ ਬੈਠੇ ਕਰ ਸਕਦੇ ਹਾਂ ਸਪੋਟੀਫਾਈ ਇਸ ਲਈ ਸਾਨੂੰ ਬਹੁਤ ਬੈਸਟ ਹੈ ਉਸ ਤੋਂ ਬਾਅਦ ਔਨਲਾਈਨ ਸੰਗੀਤ ਡਾਊਨਲੋਡ ਕਰਨ ਲਈ ਸਾਨੂੰ ਪਹਿਲਾਂ ਭੌਤਿਕ ਵਿਧੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਵੇਂ ਕਿ ਸਾਨੂੰ ਔਨਲਾਈਨ ਖਰੀਦਣ ਦੀ ਨਹੀਂ ਸੀ ਸੁਵਿਧਾ ਅਤੇ ਸਾਨੂੰ ਸੀਡੀਜ ਕੈਸਟਸ ਖਰੀਦਣੀਆਂ ਪੈਂਦੀਆਂ ਸੀ ਉਹ ਹੁਣ ਉਪਲਬਧ ਨਹੀਂ ਹੁੰਦੀਆਂ ਜਾਂ ਕਈ ਵਾਰ ਅਸੀਂ ਜਿਸ ਟੋਪਿਕ 'ਤੇ ਸਾਨੂੰ ਉਹ ਸੀਡੀ ਕੈਸਟ ਚਾਹੀਦੀ ਹੁੰਦੀ ਕਈ ਵਾਰ ਉਪਲੱਬਧ ਵੀ ਨਹੀਂ ਹੁੰਦੀ ਉਸ ਨੂੰ ਪਾਉਣ ਲਈ ਸਾਨੂੰ ਅਨੇਕਾਂ ਹੀ ਜਗ੍ਹਾ 'ਤੇ ਧੱਕੇ ਵੀ ਖਾਣੇ ਪੈਂਦੇ ਸੀ ਉਹ ਉਪਲੱਬਧ ਨਹੀਂ ਹੋ ਪਾਉਂਦੀ ਸੀ ਇਸ ਲਈ ਫਿਰ ਔਨਲਾਈਨ ਸਿਸਟਮ ਆ ਗਿਆ ਸਪੋਟੀਫਾਈ ਦੀ ਹੈਲਪ ਦੇ ਨਾਲ ਸਾਨੂੰ ਇਹ ਔਨਲਾਈਨ ਡਾਊਨ ਡਾਊਨਲੋਡ ਦੀ ਜਿਹੜੀ ਸੁਵਿਧਾ ਉਹ ਮਿਲ ਗਈ ਜਿਸ ਦੇ ਨਾਲ ਨਾਲ ਕਿਸੇ ਡਾਊਨਲੋਡ ਆਪਾਂ ਘਰ ਬੈਠੇ ਜਦੋਂ ਮਰਜੀ ਕਰ ਸਕਦੇ ਹਾਂ